ਗੁੱਡ ਆਫਟਰਨੂਨ ਜੀ ਮੈਮ ਜੀ ਜੀ ਮੈਂ ਇਹ ਦੱਸਣਾ ਚਾਹੁੰਦਾ ਕਿ ਜਿੰਨੇ ਵੀ ਹੁਸ਼ਿਆਰਪੁਰ ਦੇ ਸਾਡੇ ਨਿਊ ਜਨਰੇਸ਼ਨਾਂ ਚਾਹੇ ਉਹ ਸਟਡੀ ਦੇ ਲਈ ਜਾ ਰਹੇ ਨੇ ਜਾਂ ਵਰਕ ਦੇ ਲਈ ਜਾ ਰਹੇ ਨੇ ਜਿੱਦਾਂ ਵੀ ਉਹ ਹੈਗੇ ਉਹ ਸਾਡੀ ਹੁਸ਼ਿਆਰਪੁਰ ਦੇ ਵਿੱਚ ਇੱਦਾਂ ਦੀਆਂ ਫੈਸਿਲਟੀਜ਼ ਨਹੀਂ ਹੈਗੀਆਂ ਜੋ ਕਿ ਬਾਹਰ ਜਿੱਦਾਂ ਬਹੁਤ ਜ਼ਿਆਦਾ ਅੱਛੀ ਫੈਸਿਲਿਟੀਜ਼ ਮਿਲਦੀ ਆ ਬੱਚਿਆਂ ਨੂੰ ਸਟਡੀ ਦੇ ਵਿੱਚ ਵੀ ਜਾਂ ਉਹ ਕੰਮ ਕਰਦੇ ਆ ਉਹਨਾਂ ਦੇ ਵੀ ਕੰਮਾਂ ਦੇ ਵਿੱਚ ਵੀ ਬਹੁਤ ਅੱਛੀ ਉਹਨਾਂ ਨੂੰ ਸਹਾਇਤਾ ਮਿਲਦੀ ਆ ਜੋ ਸਾਡੇ ਇੱਥੇ ਹੁਸ਼ਿਆਰਪੁਰ ਦੇ ਵਿੱਚ ਨਹੀਂ ਹੈ ਜਿੱਦਾਂ ਕਿ ਮੈਂ ਸਟਡੀ ਦੀ ਗੱਲ ਕਰਦਾ ਹਾਂ ਅਤੇ ਸਟਡੀ ਦੇ ਵਿੱਚ ਬੱਚਿਆਂ ਨੂੰ ਵਧੀਆ ਪ੍ਰਯੋਗਸ਼ਾਲਾਵਾਂ ਜਾਂ ਬ ਬੈਠਣ ਲਈ ਲਾਈਬ੍ਰੇਰੀਆਂ ਦੀ ਗੱਲ ਕਰਦਾ ਹਾਂ ਬੱਚਿਆਂ ਨੂੰ ਬੁਕਸ ਪ੍ਰੋਵਾਈਡ ਜੋ ਵੀ ਹੁੰਦੀਆਂ ਨੇ ਜਾਂ ਉਹਨਾਂ ਦੇ ਅ ਤੇ ਜਿੰਨੇ ਵੀ ਅ ਆਊਟ ਸੋਰਸਿਜ ਅ ਜੋ ਵੀ ਬੱਚਿਆਂ ਦੀ ਸਟੱਡੀ ਦੇ ਵਿੱਚ ਹੈਲਪਫੁਲ ਹੁੰਦੀਆਂ ਨੇ ਉਹ ਸਾਡੇ ਹੁਸ਼ਿਆਰਪੁਰ ਦੇ ਵਿੱਚ ਮੇ ਵੀ ਨਹੀਂ ਹੁੰਦੀਆਂ ਖ਼ਾਸ ਕਰਕੇ ਸਾਡੇ ਕੋਲਜਸ ਦੇ ਵਿੱਚ ਟੀਚਰਾਂ ਦਾ ਪੜ੍ਹਾਉਣ ਦਾ ਢੰਗ ਫੋਰਨ ਦੀ ਟੀਚਰਾਂ ਦੇ ਵਿੱਚ ਬਹੁਤ ਜ਼ਿਆਦਾ ਵਧੀਆ ਐਕਸਪੀਰੀਅੰਸ ਦੇਖਣ ਨੂੰ ਮਿਲਦਾ ਆ ਉੱਥੋਂ ਦੀ ਸਟੂਡੈਂਟ ਜਿੰਨੇ ਵੀ ਹੁੰਦੇ ਨੇ ਵਧੀਆ ਆਪਣੀ ਸਟਡੀ ਕਰਕੇ ਇੱਕ ਵਧੀਆ ਜੋਬ ਜਾਂ ਵਧੀਆ ਮ ਬਿਜਨਸਮੈਨ ਬਣਦੇ ਨੇ ਸਾਡੇ ਇਹਨਾਂ ਸਟੂਡੈਂਟਾਂ ਨੂੰ ਇਸ ਹਿਸਾਬ ਦਾ ਅ ਸਹਾਇਤਾ ਨਹੀਂ ਮਿਲ ਪਾਉਂਦੀ ਗੀ ਜੋ ਕਿ ਸਾਨੂੰ ਬਾਹਰ ਵਧੀਆ ਮਿਲਦੀ ਨੇ ਇਹ ਜਾਂ ਮੈਂ ਦੂਜੀ ਗੱਲ ਕਰਦਾ ਹਾਂ ਜੋ ਸਟੂਡੈਂਟ ਕੰਮ ਦੇ ਬਿਹਾਫ 'ਤੇ ਜਾਂਦੇ ਨੇ ਕੰਮ ਨੂੰ ਲੈ ਕੇ ਉਹ ਆਪਣਾ ਉੱਥੇ ਉਹਨਾਂ ਨੂੰ ਅ ਵਧੀਆ ਕੰਮ ਮਿਲਦਾ ਆ ਵਧੀਆ ਕੰਮ ਦੇ ਨਾਲ ਨਾਲ ਉਹਨਾਂ ਨੂੰ ਪੈਸਿਆਂ ਦੀ ਗੱਲ ਕਰਦੇ ਹਾਂ ਤਾਂ ਪੈਸੇ ਵੀ ਅੱਛੇ ਮਿਲਦੇ ਨੇ ਉਹਨਾਂ ਨੂੰ ਕੰਮ ਕਰਨ ਦੇ ਔਰ ਕੰਮ ਦੇ ਨਾਲ ਉਹਨਾਂ ਦੀ ਜੋ ਵੀ ਕਹਿ ਸਕਦੇ ਆਪਾਂ ਸਿਹਤ ਦੀ ਜਾਂ ਨਾ ਨਾਲ ਪੋਲਸਿਜ ਹੁੰਦੀਆਂ ਨੇ ਉਹਨਾਂ ਨੂੰ ਹਾਂ ਵਧੀਆ ਮਿਲਦੀਆਂ ਨੇ ਜੇ ਅਗਰ ਉਹਨਾਂ ਨੂੰ ਉਹਨਾਂ ਦੇ ਬੱਚੇ ਜਾਂ ਉਹ ਖੁਦ ਬਿਮਾਰ ਪੈਂਦੇ ਨੇ ਤਾਂ ਉੱਥੋਂ ਦੇ ਹੋਸਪੀਟਲ ਜਾਂ ਉੱਥੋਂ ਦੀ ਸਰਕਾਰਾਂ ਨੇ ਵਧੀਆ ਆ ਫੈਸਿਲਟੀਜ਼ ਦਿੰਦੇ ਨੇ ਉਹਨਾਂ ਨੂੰ ਉਹਨਾਂ 'ਤੇ ਜ਼ਿਆਦਾ ਲੋਡ ਨਹੀਂ ਪੈਂਦਾ ਗਾ ਇੱਦਾਂ ਹੀ ਬੱਚਿਆਂ ਜਿੱਦਾਂ ਕਿ ਬੱਚੇ ਦੀ ਗੱਲ ਕਰਦੇ ਹਾਂ ਜੋ ਫੈਮਿਲੀ ਹੁੰਦੀਆਂ ਨੇ ਉਹਨਾਂ ਦੇ ਬੱਚਿਆਂ ਦੀ ਵੀ ਅ ਸਰਕਾਰ ਵੱਲੋਂ ਵਧੀਆ ਸਹੂਲਤ ਪੜ੍ਹਾਈ ਦੇ ਵਿੱਚ ਹੈਲਪ ਮਿਲਦੀ ਆ ਇੱਦਾਂ ਹੀ ਅਤੇ ਹਾਂ ਬੇਰੁਜ਼ਗਾਰੀ ਵੀ ਹੈਗੀ ਆ ਸਾਡੇ ਇੱਥੇ ਬੱਚੇ ਜ਼ਿਆਦਾ ਪੜ੍ਹ ਲਿਖ ਲੈਂਦੇ ਨੇ ਪਰ ਉਹਨਾਂ ਨੂੰ ਉਹਨਾਂ ਦੀ ਪੜ੍ਹਾਈ ਦੇ ਮੁਤਾਬਿਕ ਕੋਈ ਕੰਮ ਨਹੀਂ ਮਿਲਦਾ ਰੁਜ਼ਗਾਰ ਨਹੀਂ ਮਿਲਦਾ ਖ਼ਾਸ ਕਰਕੇ ਸਾਡੀ ਨਿਊ ਜਨਰੇਸ਼ਨ ਅ ਜੋ ਕਿ ਸਾਰੀਆਂ ਡਿਗਰੀਆਂ ਕਰਕੇ ਘਰਾਂ ਦੇ ਵਿੱਚ ਬੇਰੁਜਗਾਰ ਬੈਠੇ ਹੋਏ ਨੇ ਪਰ ਫੋਰਨ ਦੇ ਵਿੱਚ ਇਹ ਕੁਛ ਨਹੀਂ ਹੈਗਾ ਗਾ ਉਹਨਾਂ ਦੇ ਅਕੋਰਡਿੰਗ ਉਹ ਜੇ ਉਹ ਜਿੰਨੀ ਵੀ ਸਟਡੀ ਕਰਦੇ ਨੇ ਉਸ ਦੇ ਅਕੋਰਡਿੰਗ ਉਹਨੂੰ ਜੋਬ ਮਿਲਦੀ ਆ ਉਹਨਾਂ ਨੂੰ ਅੱਛੇ ਪੈਸੇ ਮਿਲਦੇ ਨੇ ਅੱਛੀਆਂ ਸਹੂਲਤਾਂ ਮਿਲਦੀਆਂ ਨੇ ਤਾਂ ਕਰਕੇ ਸਾਡੇ ਵੀ ਹੁਸ਼ਿਆਰਪੁਰ ਦੇ ਤਕਰੀਬਨ ਜਿੰਨੇ ਵੀ ਨੌਜਵਾਨ ਬਾਹਰ ਜਾਣਾ ਚਾਹੁੰਦੇ ਉਹ ਇਹਨਾਂ ਚੀਜ਼ਾਂ ਨੂੰ ਹੀ ਦੇਖ ਕੇ ਉਹ ਬਾਹਰ ਜਾਂਦੇ ਨੇ ਅਤੇ ਵਧੀਆ ਉੱਥੇ ਕੰਮ ਕਰਦੇ ਨੇ ਇਹਨਾਂ ਚੀਜ਼ਾਂ ਨੂੰ ਹੀ ਦੇਖਦੇ ਹੋਏ ਅਤੇ ਵਧੀਆ ਪੈਸੇ ਕਮਾਉਂਦੇ ਨੇ ਹਾਂਜੀ ਥੈਂਕ ਯੂ ਥੈਂਕ ਯੂ ਸੋ ਮਚ